ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਨਾਂ ਪੂਜਾ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਇਸਲਾਮਾਬਾਦ ਮੁਹੱਲੇ ਗੋਪਾਲਸਾ ਰੋਡ ਤਰ ਨਵੀਨੇ ਹੈਲਥ ਕਲੱਬ ਦੇ ਨਜ਼ਦੀਕ ਜੇ ਮੈਨੂੰ ਬੁਣਵਾਈ ਦਾ ਬਚਪਨ ਤੋਂ ਬਹੁਤ ਸ਼ੌਂਕ ਰਿਹਾ ਹੈ ਮੈਂ ਕਾਫੀ ਤਰ੍ਹਾਂ ਦੇ ਡਿਜ਼ਾਇਨਰ ਸਵੈਟਰ ਮੋਜੇ ਗਲੱਵਸ ਵਗੈਰਾ ਬਣਾਉਂਦੀ ਰਹੀ ਹਾਂ ਔਰ ਮੇਰੀ ਮੰਮਾ ਨੂੰ ਵੀ ਕਾਫੀ ਸ਼ੌ ਸੌਂਕ ਰਿਹਾ ਮੈਂ ਆਪਣੀ ਮੰਮਾ ਕੋਲ ਬਣਵਾਈ ਦਾ ਕੰਮ ਸਿੱਖਿਆ ਹੈ ਔਰ ਮੇਰੀ ਮੰਮਾ ਕਾਫੀ ਅੱਛੀ ਤਰ੍ਹਾਂ ਦਾ ਡਿਜ਼ਾਇਨਰ ਸਵੈਟਰ ਵਗੈਰਾ ਬੁਣਾਈ ਕਰਦੇ ਹਨ ਮੈਂ ਵੀ ਇਹਨਾਂ ਕੋਲ ਕਾਫੀ ਇੱਛਾ ਹੋਣ ਦੇ ਕਾਰਨ ਮੈਂ ਵੀ ਉਹਨਾਂ ਕੋਲ ਕਾਫੀ ਸਵੈਟਰ ਅੱਛੀ ਅੱਛੀ ਤਰ੍ਹਾਂ ਦੇ ਸ਼ਰੱਗ ਵਗੈਰਾ ਬਣਾਏ ਔਰ ਅਸੀਂ ਉਹਨਾਂ ਨੂੰ ਅਸੀਂ ਆਪਣੀ ਸ਼ੋਪ 'ਤੇ ਉਹਨਾਂ ਨੂੰ ਟੀਚ ਕਰਦੇ ਹਾਂ ਉਸ ਕਾਫੀ ਮੱਕੀ ਸੇਲ ਜੈਸੇ ਕੀ ਮੋਜੇ ਗਲੱਵਸ ਵਗੈਰਾ ਉਹਨਾਂ ਨੂੰ ਬੁਣਾਈ ਕਰਦੇ ਹਾਂ ਹਰ ਤਰ੍ਹਾਂ ਦੇ ਸਵੈਟਰ ਜੈਸੇ ਲੇਡੀਜ਼ ਅ ਜੈਂਟਸ ਅ ਬੇਬੀਸ ਅ ਗਰਲਸ ਬੋਆਇਸ ਹਰ ਤਰ੍ਹਾਂ ਦੇ ਸਵੈਟਰ ਦੀ ਬੁਣਾਈ ਕਰਦੇ ਹਾਂ ਅਤੇ ਅਤੇ ਉਸ ਉਹ ਮਫਲਰ ਵਗੈਰਾ ਦੀ ਅਸਟੀ ਸਟੀਵਰ ਕਰਦੇ ਹਾਂ ਬੁਣਵਾਈ ਕਰਦੇ ਹਾਂ ਅਸੀਂ ਮੇਰੀ ਮੰਮਾ ਤੋਂ ਕਾਫੀ ਅਕਸਪੀਰੀਅੰਸ ਹੈ ਸਿਖਾਈ ਦਾ ਮੰਮਾ ਹਰ ਤਰ੍ਹਾਂ ਦੇ ਡਿਜ਼ਾਇਨ ਸ਼ਰੱਗ ਹਰ ਤਰ੍ਹਾਂ ਦਾ ਕੋਈ ਵੀ ਬੁਣਾਈ ਦਾ ਕੰਮ ਬੜੇ ਅੱਛੇ ਤਰੀਕੇ ਨਾਲ ਕਰ ਲੈਂਦੇ ਹੈ ਔਰ ਮੇਰੀ ਵੀ ਇੱਛਾ ਹੋਣ ਦੇ ਕਰਕੇ ਮੈਂ ਵੀ ਮੰਮਾ ਕੋਲ ਸਾਰੇ ਡਿਜ਼ਾਇਨ ਵਗੈਰਾ ਸਿੱਖੇ ਹੋਏ ਹੈ ਔਰ ਅੱਜ ਵੀ ਸਿੱਖ ਰਹੀ ਹਾਂ ਮੰਮਾ ਕੋਲ ਜੈਸੇ ਕਿ ਲੇਡੀਸ ਜੈਂਟਸ ਮਫਲਰ ਵਗੈਰਾ ਹਰ ਤਰ੍ਹਾਂ ਦਾ ਸਵੈਟਰ ਦੀ ਬੁਣਾਈ ਕਰਨਾ ਡਿਜ਼ਾਇਨ ਅੱਛੇ ਅੱਛੇ ਉਹਨਾਂ ਕੋਲ ਡਿਜ਼ਾਇਨ ਸਿੱਖਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਔਰ ਮੈਂ ਨਾ ਅੱਗੇ ਵੀ ਇਹੀ ਇੱਛਾ ਹੈ ਕਿ ਮੰਮਾ ਇਸ ਤੋਂ ਵੀ ਵਧੀਆ ਹੋਰ ਸਿੱਖ ਕਰਨ ਔਰ ਮੈਂ ਵੀ ਉਹਨਾਂ ਕੋਲ ਸਿੱਖਾ ਔਰ ਅਸੀਂ ਅੱਗੇ ਵੀ ਲੜਕੀਆਂ ਨੂੰ ਸ ਸਿੱਖਿਆ ਦਈਏ ਔਰ ਉਹਨਾਂ ਨੂੰ ਬੁਨਾਈ ਦੀ ਹੀ ਬੁਣਾਈ ਹੋਣ ਸਵੈਟਰ ਡਾਲਣ ਔਰ ਕਾਫੀ ਅੱਛੇ ਲੱਗਦੇ ਹੈ ਉਹਨਾਂ 'ਤੇ ਡਿਜ਼ਾਇਨ ਵਗੈਰਾ ਕੀਤਾ ਜੈਸੇ ਕਿ ਮੋਤੀਆਂ 'ਤੇ ਡਿਜ਼ਾਇਨ ਡਾਲਨਾ ਔਰ ਜੈਸੇ ਕਿ ਕਲਰਫੁੱਲ ਸਵੈਟਰਸ ਵਿੱਚ ਬੁਣਾਈ ਕਰਨਾ ਅਤੇ ਬਹੁਤ ਵਧੀਆ ਮੰਮਾ ਕਰਦੇ ਆ ਔਰ ਮੈਂ ਵੀ ਮੰਮਾ ਕੋਲ ਸਿੱਖ ਰਹੀ ਹਾਂ ਪਰ ਇਹੀ ਹੈ ਕਿ ਅਸੀਂ ਅੱਗੇ ਵੀ ਆਉਣ ਵਾਲੀ ਜਨਰੇਸ਼ਨ ਇਸ ਬਾ ਇਸ ਬੁਣਾਈ ਦੀ ਸਿੱਖ ਦੱਸੀਏ ਉਹਨੂੰ ਬਣਾਉਣਾ ਸਿਖਾਈਏ ਸਿਲਾਈ ਚਲਾਉਣਾ ਕਿਸ ਤਰ੍ਹਾਂ ਅਸੀਂ ਬਚਪਨ ਤੋਂ ਹੀ ਸ ਬੁਣੇ ਹੋਏ ਸਵੈਟਰ ਡਾਲਨੇ ਹਾਂ ਉਹਨਾਂ ਦੇ ਕਾਫੀ ਤਰ੍ਹਾਂ ਜਿੱਦਾਂ ਕਿ ਹੁਣ ਠੰਡ ਡਿਕੋਜ਼ ਹੁੰਦੀ ਹੈ ਜੋ ਬਹੁਤ ਵਧੀਆ ਲੱਗਦੇ ਹੈ ਪਾ ਡਾਲਨ 'ਚ ਵੀ ਬੱਚਿਆਂ ਦੇ ਬੇ ਬੱਚਿਆਂ ਦੇ ਤਾਂ ਕਾਫੀ ਤਰ੍ਹਾਂ ਦੇ ਸੂਟ ਜਿੱਦਾਂ ਪਜਾਮੇ ਵੀ ਵਗੈਰਾ ਸਵੈਟਰ ਦੀ ਪਜਾਮੇ ਵੀ ਹਿੱਲ ਨਾਲ ਹੀ ਬਣਾਉਂਦੇ ਹਾਂ ਛੋਟੇ ਦੇ ਅਤੇ ਬਹੁਤ ਵਧੀਆ ਲੱਗਦੇ ਹੈ